ਰਸੋਈਆਂ ਵਿੱਚ ਅਸੀਂ ਅਕਸਰ ਚੂਹੇ ਅਤੇ ਕੋਕਰੋਚ ਤੋਂ ਪਰੇਸ਼ਾਨ ਰਹਿੰਦੇ ਹਾਂ ਇਹਨਾਂ ਤੋਂ ਬਚਣ ਲਈ ਸਾਡੇ ਕੋਲ ਸਪਰੇਅ ਹੁੰਦਾ ਹੈ ਚੂਹਿਆਂ ਦੀਆਂ ਖੁੱਡਾਂ ਨੂੰ ਬੰਦ ਕੀਤਾ ਜਾਂਦਾ ਹੈ ਅਸੀਂ ਕੋਕਰੋਚਾਂ ਤੋਂ ਬਚਣ ਲਈ ਆਪਣੇ ਭਾਂਡਿਆਂ ਨੂੰ ਕੰਸ ਦੇ ਉੱਤੇ ਟਿਕਾਉਂਦੇ ਹਾਂ ਅਤੇ ਉਹਨਾਂ ਤੋਂ ਬਚਣ ਲਈ ਸਪ੍ਰੇ ਵੀ ਕਰਦੇ ਹਾਂ ਚੂਹਿਆਂ ਤੋਂ ਬਚਣ ਲਈ ਅਸੀਂ ਪਿੰਜਰੇ ਲਗਾਉਂਦੇ ਹਾਂ ਉਹਨਾਂ ਵਿੱਚ ਚੂਹਿਆਂ ਨੂੰ ਫੜ ਕੇ ਖੇਤਾਂ ਵਿੱਚ ਦੂਰ ਜਾ ਕੇ ਛੱਡ ਦਿੰਦੇ ਹਾਂ